ਇੱਕੀ ਜੁਲਾਈ ਦੋ ਹਜ਼ਾਰ ਤਿੰਨ ਛੇ ਮਈ ਦੋ ਹਜ਼ਾਰ ਉੱਨੀ ਅਠਾਰ੍ਹਾਂ ਏਪ੍ਰੈਲ ਦੋ ਹਜ਼ਾਰ ਸਤਾਰ੍ਹਾਂ ਨੌ ਨਵੰਬਰ ਦੋ ਹਜ਼ਾਰ ਤੇਈ ਤਿੰਨ ਜਨਵਰੀ ਦੋ ਹਜ਼ਾਰ ਤੇਈ